ਹਾਂ ਮੈਂ ਮੇਰੇ ਕੋਲ ਇੱਕ ਕੁੱਕ ਕੁਕਿੰਗ ਬੁੱਕ ਹੈ ਜਿਸਦਾ ਨਾਮ ਹੈ ਵਿਲੇਜ਼ ਕੁਕਿੰਗ ਬੁੱਕ ਇਹ ਇੱਕ ਬਹੁਤ ਹੀ ਵਧੀਆ ਕਿਤਾਬ ਹੈ ਅਤੇ ਮੇਰੀ ਸਹੇਲੀਆਂ ਵਰਗੀ ਹੈ ਇਸ ਵਿੱਚ ਸਾਰੀ ਤਰ੍ਹਾਂ ਦੀਆਂ ਦੇਸੀ ਸਾਊਥ ਇੰਡੀਅਨ ਪੰਜਾਬੀ ਬੈਂਗੋਲੀ ਹਰ ਤਰ੍ਹਾਂ ਦੇ ਖਾਣਿਆਂ ਬਾਰੇ ਦੱਸਿਆ ਗਿਆ ਹੈ ਮੈਂ ਜ਼ਿਆਦਾਤਰ ਖਾਣਾ ਇਹ 'ਤੇ ਵੇਖ ਕੇ ਹੀ ਬਣਾਉਂਦੀ ਹਾਂ ਖ਼ਾਸ ਕਰਕੇ ਜਦੋਂ ਕੋਈ ਘਰ ਵਿੱਚ ਜਨਮ ਦਿਨ ਪਾਰਟੀ ਜਾਂ ਕੋਈ ਵੀ ਨਿੱਕੇ ਮੋਟੇ ਫੰਕਸ਼ਨ ਹੁੰਦੇ ਹਨ ਤਾਂ ਮੈਂ ਖਾਣਾ ਇੱਥੋਂ ਦੇਖ ਕੇ ਬਣਾਉਂਦੀ ਹਾਂ ਇਸ ਵਿੱਚ ਸਾਰੀ ਤਰ੍ਹਾਂ ਦੇ ਖਾਣਿਆਂ ਬਾਰੇ ਦੱਸਿਆ ਗਿਆ ਹੈ ਸ਼ਾਕਾਹਾਰੀ ਮਾਸਾਹਾਰੀ ਮਠਿਆਈਆਂ ਸਬਜ਼ੀਆਂ ਅਤੇ ਸਨੈਕਸ ਆਦਿ ਦੀ ਪੂਰੀ ਜਾਣਕਾਰੀ ਦਿੱਤੀ ਹੈ ਚਾਹ ਨਾਲ ਖਾਣ ਵਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਸਮੋਸੇ ਗੁਲਾਬ ਜਾਮੁਨ ਪੀਜ਼ਾ ਆਲੂ ਰੋਲ ਸਪਰਿੰਗ ਰੋਲ ਢੋਕਲਾ ਆਦਿ ਇਹਨਾਂ ਵਿੱਚ ਪੂਰੀ ਤਰ੍ਹਾਂ ਦੱਸਿਆ ਗਿਆ ਹੈ ਜਿਸ ਦਾ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਅਤੇ ਸਰਲ ਹੈ ਅਤੇ ਵੇਖ ਕੇ ਬਣਾ ਕੇ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਵੇਖ ਕੇ ਹੀ ਮੈਂ ਬਣਾਉਂਦੀ ਹਾਂ ਪਿਛਲੀ ਵਾਰ ਜਦੋਂ ਮੇਰੇ ਘਰ ਪਾਰਟੀ ਸੀ ਤਾਂ ਮੈਂ ਇਸ ਹੀ ਕੁਕਿੰਗ ਬੁੱਕ ਦੇ ਵਿੱਚੋਂ ਵੇਖ ਕੇ ਚੀਜ਼ਾਂ ਬਣਾਈਆਂ ਸਨ ਅਤੇ ਮੇਰੀਆਂ ਚੀਜ਼ਾਂ ਸਾਰਿਆਂ ਨੂੰ ਬਹੁਤ ਪਸੰਦ ਆਈਆਂ ਸਨ ਅਤੇ ਉਹਨਾਂ ਨੇ ਮੇਰੇ ਕੋਲ ਇਸ ਬਾਰੇ ਪੁੱਛਿਆ ਸੀ ਕਿ ਤੁਸੀਂ ਇੱਕ ਇਹ ਚੀਜ਼ਾਂ ਕਿੱਥੋਂ ਦੇਖ ਕੇ ਬਣਾਉਂਦੇ ਹੋ ਫਿਰ ਮੈਂ ਉਹਨਾਂ ਨੂੰ ਇਸ ਕਿਤਾਬ ਦੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਇਹ ਕਿਤਾਬ ਮੈਂ ਉਹਨਾਂ ਨੂੰ ਮੰਗਵਾ ਕੇ ਵੀ ਦਿੱਤੀ ਸੀ ਇਸ ਲਈ ਮੈਂ ਇਹ ਕਿਤਾਬ ਤਾਂ ਮੇਰੇ ਲਈ ਇੱਕ ਤਰ੍ਹਾਂ ਦਾ ਵਰਦਾਨ ਸਾਬਿਤ ਹੋਈ ਹੈ ਇਹ ਮੇਰੇ ਸਹੁਰੇ ਪਰਿਵਾਰ ਮੈਂਬ ਮੈਂ ਉਸ ਪਰਿਵਾਰ ਦੇ ਮੈਂਬਰ ਬਹੁਤ ਪਸੰਦ ਕਰਦੇ ਹਨ ਕਿ ਬਹੁਤ ਵਧੀਆ ਚੀਜ਼ਾਂ ਬਣਾਉਂਦੀ ਹਾਂ ਸਿਖਾਉਂਦੀ ਹਾਂ ਇਹ ਚੀਜ਼ਾਂ ਇਹੋ ਜਿਹੀਆਂ ਸਵਾਦ ਏ ਦੇਖ ਕੇ ਇਹੋ ਜਿਹੀਆਂ ਸਵਾਦ ਬਣਦੀਆਂ ਹਨ ਕਿ ਲੋਕ ਖਾ ਕੇ ਖੁਸ਼ ਹੋ ਘਰ ਦੇ ਖਾ ਕੇ ਖੁਸ਼ ਹੋ ਜਾਂਦੇ ਹਨ ਅਤੇ ਖਾਣ ਪੇਟ ਦੇ ਜ਼ਰੀਏ ਹੀ ਤੁਹਾਡਾ ਰਿਸ਼ਤਾ ਜਿਹੜਾ ਕੀ ਹੈ ਤੁਹਾਡੇ ਹਰੇਕ ਰਿਸ਼ਤੇ 'ਚ ਮਜਬੂਤ ਹੋ ਜਾਂਦਾ ਹੈ ਇੱਥੋਂ ਤੱਕ ਕਿ ਜਦੋਂ ਕਿ ਜਦੋਂ ਮੇਰੀ ਕਿਸੇ ਵੀ ਸਹੇਲੀ ਦੇ ਘਰ ਕਿੱਟੀ ਪਾਰਟੀ ਹੁੰਦੀ ਹੈ ਜਾਂ ਜਨਮਦਿਨ ਪਾਰਟੀ ਹੁੰਦੀ ਹੈ ਉਹ ਖੁਸ਼ ਕਰਦੇ ਕਰਕੇ ਮੈਨੂੰ ਪੁੱਛਦੇ ਹਨ ਕਿ ਤੁਸੀਂ ਮੇਰੇ ਵ ਮੇਰੇ ਘਰ ਕੋਈ ਜਦੋਂ ਆਉਗੇ ਕੋਈ ਇੱਕ ਚੀਜ਼ ਬਣਾਉਂਦੇ ਲੈ ਕੇ ਆਉਣਾ ਤਾਂ ਮੇਰੀ ਮੈਂ ਉਸ ਦੀ ਉੱਥੇ ਜਾ ਬਣਾ ਕੇ ਵੀ ਲੈ ਕੇ ਜਾਂਦੀ ਹਾਂ ਅਤੇ ਮੈਂ ਉੱਥੇ ਜਾ ਕੇ ਉਸਦੀ ਮਦਦ ਵੀ ਕਰਦੀ ਹਾਂ ਮੇਰਾ ਮਨਪਸੰਦ ਪਹਿਰਾ ਖਾਣਾ ਹੈਗਾ ਹੈ ਢੋਕਲਾ ਇਸ ਨੂੰ ਬਣਾਉਣ ਲਈ ਮੈਂ ਕਈ ਤਰ੍ਹਾਂ ਦੇ ਚੀਜ਼ਾਂ ਦਾ ਇਸਤੇਮਾਲ ਕਰਦੀ ਹੈਗੀ ਹਾਂ ਅਤੇ ਕਈ ਕਈ ਤਰ੍ਹਾਂ ਦੇ ਢੋਕਲੇ ਜਿਹੜੇ ਆ ਕਿ ਮੈਂ ਬਣਾਉਂਦੀ ਹਾਂ ਮੈਂ ਖਾਣਾ ਬਣਾਉਣ ਲਈ ਜਾਂ ਬਲੋਗਰਾਂ ਨੂੰ ਵੀ ਇਹੀ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਵਲੋਗਿੰਗ ਕਰਦੇ ਹੋ ਬਹੁਤ ਸੋਹਣੀ ਚੀਜ਼ ਹੈ ਪਰ ਕਈ ਵਾਰੀ ਉਹਨਾਂ ਖਾਣਿਆਂ ਨੂੰ ਆਪ ਵੀ ਬਣਾ ਕੇ ਟਰਾਈ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਖਾਣਾ ਬਣਾਉਣਾ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਛੋਟੀ ਜਿਹੀ ਗੱਲ ਹੈ